ਆਮ ਤੌਰ 'ਤੇ ਅਸੀਂ ਕਿਸੇ ਵੀ ਧਾਰਮਿਕ ਮੌਕੇ ਉੱਤੇ ਦੇਵਤਿਆਂ ਦੀ ਮੂਰਤੀ ਨਹੀਂ ਬਣਾਉਂਦੇ ਪਰ ਪਿਛਲੀ ਵਾਰੀ ਗਨੇਸ਼ ਚਤੁਰਥੀ 'ਤੇ ਜਦੋਂ ਮੈਂ ਆਪਣੀ ਕਜ਼ਨਸ ਨਾਲ ਸੀ ਤਾਂ ਉਸ ਸਮੇਂ ਅਸੀਂ ਸੋਚਿਆ ਵੀ ਅਸੀਂ ਗਨੇਸ਼ ਜੀ ਦੀ ਮੂਰਤੀ ਆਪਣੇ ਹੱਥੀਂ ਡਿਜ਼ਾਇਨ ਕਰਾਂਗੇ ਇਸ ਕਰਕੇ ਅਸੀਂ ਬਹੁਤ ਹੀ ਤ ਮਿਹਨਤ ਮੁਸ਼ੱਕਤ ਦੇ ਬਾਅਦ ਬਹੁਤ ਇੱਕ ਵਧੀਆ ਗੁੰਝਲਦਾਰ ਡਿਜ਼ਾਇਨ ਤਿਆਰ ਕੀਤਾ ਉਸ ਤੋਂ ਬਾਅਦ ਅਸੀਂ ਮਿੱਟੀ ਦੇ ਨਾਲ ਗਨੇਸ਼ ਜੀ ਦੀ ਮੂਰਤੀ ਬਣਾਈ ਅਤੇ ਮੇਰੇ ਦੂਜੇ ਕਜ਼ਨ ਨੇ ਉਸ ਉੱਤੇ ਪੇਂਟ ਕਰਿਆ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਸੀਗਾ ਉਸ ਉਪਰੰਤ ਅਸੀਂ ਇਸ ਨੂੰ ਗਣਪਤੀ ਵਿਸਥਾਪਨ ਤੋਂ ਗਣਪਤੀ ਵਿਸਰਜਨ ਤੱਕ ਬਹੁਤ ਹੀ ਸਾਂਭ ਸਾਂਭ ਕੇ ਰੱਖਿਆ ਅਤੇ ਜਿੱਦਣ ਅਸੀਂ ਗਣਪਤੀ ਵਿਸਰਜਨ ਕੀਤਾ ਉੱਦਣ ਅਸੀਂ ਬਹੁਤ ਰੋਏ ਕਿਉਂਕਿ ਇਸ ਮੂਰਤੀ ਦੇ ਨਾਲ ਸਾਡਾ ਮਨੋ ਲਗਾਅ ਲਗਾਅ ਸੀਗਾ ਕਿਉਂਕਿ ਅਸੀਂ ਆਪ ਬਣਾਈ ਸੀ ਅਤੇ ਮੂਰਤੀ ਬਣਾਉਣ ਦੇ ਸਮੇਂ ਇਹ ਅਨੁਭਵ ਬਹੁਤ ਜ਼ਿਆਦਾ ਵਧੀਆ ਰਿਹਾ